ਮਾਸਟਰ ਕਰਮ ਚੰਦ ਦੁਕਾਨ ਤੋਂ ਬੋਲ ਰਹੇ ਹੋ ਜੀ ਮੈਂ ਨਾ ਆਪਣੇ ਬੱਚਿਆਂ ਦੀ ਟੈਕਸਟ ਬੁੱਕਸ ਲਈਆਂ ਸੀ ਤੁਹਾਡੇ ਕੋਲੋਂ ਉਹ ਬੁੱਕਸ ਸਹੀ ਨਹੀਂ ਹੈਗੀਆਂ ਜੀ ਕਈ ਬੁੱਕਸ ਤਾਂ ਮਿਸ ਪ੍ਰਿੰਟ ਹੈਗੇ ਨੇ ਜੀ ਪੇਜ ਅਤੇ ਕਈ ਪੇਜ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਬੁੱਕਸ ਦੇ ਵਿੱਚ ਪੇਜ ਹੀ ਹੈ ਨਹੀਂ ਹੈਗੇ ਸੈਕਿੰਡਲੀ ਉਹ ਹੈਗਾ ਵੀ ਇਹਦੇ ਵਿੱਚ ਜਿਹੜੀ ਜਿਲਦ ਜਿਹੜੀ ਬਾਇਡ ਕੀਤੀ ਹੋਈ ਤੁਸੀਂ ਉਹ ਵੀ ਖੇਰੂੰ ਖੇਰੂੰ ਹੋਈ ਹੋਈ ਵੀ ਹੈ ਅਤੇ ਕਿਤਾਬਾਂ ਤੁਹਾਡੀਆਂ ਸਹੀ ਨਹੀਂ ਹੈਗੀਆਂ ਅਤੇ ਇਹਨਾਂ ਨੂੰ ਜਾਂ ਤਾਂ ਸਾਨੂੰ ਸਾਡੀਆਂ ਬੁੱਕਸ ਜਿਹੜੀਆਂ ਹੈਗੀਆ ਚੇਂਜ ਕਰਕੇ ਦਿਓ ਅਤੇ ਜਾਂ ਸਾਡੀ ਜਿਹੜੀ ਹੈਗੀ ਹੈ ਇਹ ਬੁੱਕਸ ਵਗੈਰਾ ਸਹੀ ਕਰਵਾ ਕੇ ਦਿਓ ਕਿਉਂਕਿ ਕੱਲ੍ਹ ਹੀ ਤਾਂ ਤੁਹਾਡੇ ਕੋਲੋਂ ਲਈਆਂ ਇਹ ਜੇ ਹੁਣ ਹੀ ਇਹਨਾਂ ਬੁੱਕਸ ਦਾ ਇਹ ਹਾਲ ਹੈ ਤਾਂ ਅੱਗੇ ਤਾਂ ਹਾਲੇ ਹੋਰ ਵੀ ਬੁੱਕਸ ਵਗੈਰਾ ਪਰਚੇਜ਼ ਕਰਨੀਆਂ ਤੁਹਾਡੇ ਕੋਲੋਂ ਪਰ ਫੀਡਬੈਕ ਤੁਹਾਡੀ ਸਹੀ ਨਹੀਂ ਹੈਗੀ ਐ ਇਸ ਮਾਮਲੇ ਦੇ ਵਿੱਚ ਪਰ ਹੁਣ ਤੁਸੀਂ ਸਾਨੂੰ ਇਸ ਦੇ ਵਿੱਚ ਸੈਟਿਸਫਾਈ ਕਰਾਓ ਵੀ ਤੁਹਾਡੀਆਂ ਜਿਹੜੀਆਂ ਬੁੱਕਸ ਹੈਗੀਆਂ ਇਹਨਾਂ ਨੂੰ ਤੁਸੀਂ ਸਹੀ ਕਰੋਗੇ ਅਤੇ ਸਾਨੂੰ ਵੀ ਕਹਿਣ ਦਾ ਮਤਲਬ ਇਹ ਹੈ ਵੀ ਸਾਡਾ ਵੀ ਸਾਨੂੰ ਸਾਡੀਆਂ ਬੁੱਕਸ ਨਾਲ ਮਤਲਬ ਹੈ ਬੁੱਕਸ ਦੇ ਵਿੱਚ ਜਿਹੜੀ ਹੈਗੀ ਹੈ ਪੰਜਾਬੀ ਵੀ ਜਿਹੜੀ ਹੈਗੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਲਿਖੀ ਹੋਈ ਉਹਦੇ ਵਿੱਚ ਵੀ ਕਈ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਜਿਹੜੀਆਂ ਬੱਚਿਆਂ ਤੋਂ ਰੀਡ ਨਹੀਂ ਹੁੰਦੀਆਂ ਹੈਗੀਆਂ ਅਤੇ ਸਾਡੀਆਂ ਜਿਹੜੀਆਂ ਬੁੱਕਸ ਸੀਗੀਆਂ ਪਲੀਜ਼ ਚੇਂਜ ਕਰਕੇ ਦਿਓ